ਮੇਰੇ ਮੁਤਾਬਿਕ ਦੌੜ ਇੱਕ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਮੈਂ ਆਪ ਇੱਕ ਐਥਲੀਟ ਦਾ ਖਿਡਾਰੀ ਹਾਂ ਅਤੇ ਦੌੜਨ ਐਥਲੀਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਦੌੜਨ ਦਾ ਸਮਾਂ ਸਵੇਰੇ ਅਤੇ ਸ਼ਾਮ ਨੂੰ ਹੁੰਦਾ ਹੈ ਅਤੇ ਦੋਨੋਂ ਸਮੇਂ ਬਹੁਤ ਵਧੀਆ ਹੁੰਦੇ ਹਨ ਪਰ ਮੇਰੇ ਮੁਤਾਬਿਕ ਸਵੇਰ ਦਾ ਸਮਾਂ ਦੌੜਨ ਵਾਸਤੇ ਪੂਰਾ ਅ ਚੰਗੀ ਭੂਮਿਕਾ ਨਿਭਾਉਂਦੀ ਹੈ ਸਵੇਰ ਦੇ ਸਮੇਂ ਵਿੱਚ ਬੰਦੇ ਨੂੰ ਤਾਜ਼ੀ ਹਵਾ ਤਾਂ ਮਿਲਦੀ ਮਿਲਦੀ ਹੈ ਪਰ ਸੁਸਤੀ ਵੀ ਉਹ ਦੂਰ ਹੋ ਜਾਂਦੀ ਹੈ ਮੈਂ ਦੌੜਨ ਵਿੱਚ ਘੱਟੋ ਘੱਟ ਅੱਧਾ ਘੰਟਾ ਸ ਦਾ ਸਮਾਂ ਬਤੀਤ ਕਰਦਾ ਹਾਂ ਜਿਸ ਨਾਲ ਮੇਰ ਅ ਮੇਰੇ ਸਰੀਰ ਨੂੰ ਤੰਦਰੁਸਤੀ ਪ੍ਰਾਪਤ ਹੁੰਦੀ ਹੈ ਮੈਂ ਅੰਡਰ ਏਟੀਨ ਦਾ ਖਿਡਾਰੀ ਹਾਂ ਜਿਸ ਵਿੱਚ ਮੈਂ ਅੰਡਰ ਏਟੀਨ ਦਾ ਕੌਂਪੀਟੀਸ਼ਨ ਲੜਨਾ ਵਾ ਜਿਸ ਵ ਜਿਸ ਵਾਸਤੇ ਮੈਂ ਦੌੜਨ ਦੀ ਭੂਮਿਕਾ ਲਈ ਮੈਂ ਤਿਆਰ ਹੁੰਦਾ ਹਾਂ ਅੰਡਰ ਏਟੀਨ ਦਾ ਕੋਂਪੀਟੀਸ਼ਨ ਮੇਰੇ ਜੀਵਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਸ ਨਾਲ ਮੈਂ ਹੋਰ ਵੱਡੇ ਲੈਵਲ ਤੱਕ ਖੇਡ ਸਕਦਾ ਹਾਂ ਇਸ ਕਰਕੇ ਮੈਂ ਦੌੜਨ ਨੂੰ ਹਮੇਸ਼ਾ ਪ੍ਰੈਫਰ ਕਰਦਾ ਹਾਂ ਅਤੇ ਆਪਣੇ ਜੀਵਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦਾ ਹਾਂ